ਹੈਲੋ ਅਮਰਜੀਤ ਬੋਲਦੇ ਅਮਰਜੀਤ ਮੈਂ ਨਾ ਹਾਈਬਰੈੱਡ ਬੀਜਾਂ ਦੀ ਨਾ ਖੋਜ ਕੀਤੀ ਆ ਅਤੇ ਉਹ ਤੁਸੀਂ ਮੈਂ ਤੁਸੀਂ ਵੀ ਲਾ ਕੇ ਵੇਖੋ ਹਾਂ ਤੁਹਾਡੇ ਵੀ ਲੱਗਣਗੇ ਥੋੜ੍ਹਾ ਪੈਦਾਵਾਰ ਤੁਹਾਡੀ ਵਧੇਗੀ ਤੁਸੀਂ ਵੀ ਉਹਦੇ ਵਿੱਚ ਜ਼ਿਆਦਾ ਕਰੋਗੇ ਅਤੇ ਮੈਨੂੰ ਵੀ ਚੰਗਾ ਲੱਗਾ ਆ ਅਤੇ ਤੁਸੀਂ ਵੀ ਇਹ ਕੰਮ ਕਰੋ ਅਤੇ ਦੇਖੋ ਹਾਂ ਹੋਰ ਵਰਤ ਕੇ ਦੇਖੋ ਹਾਂ ਠੀਕ ਆ ਮੈਂ ਤੁਹਾਨੂੰ ਨੰਬਰ ਨਾ ਸੈਂਡ ਕਰਾਂਗੀ ਅਤੇ ਤੁਸੀਂ ਓਸ ਨੰਬਰ 'ਤੇ ਮੇਰੇ ਨਾਲ ਕਰ ਲਿਓ ਦੇਖ ਲਿਓ ਹਾਂ ਚਲੋ ਹਾਂ ਠੀਕ ਓਕੇ ਜੀ ਓਕੇ ਬਾਏ